ਪੰਜਾਬ ਦੇ ਸਰਕਾਰੀ ਸਕੂਲ ਪੰਜਾਬ ਸਰਕਾਰ ਦੇ ਸਿਖਲਾਈ ਸਿ ਸਿਸਟਮ ਦਾ ਹਿੱਸਾ ਹਨ ਇਹ ਸਕੂਲ ਪੰਜਾਬ ਸਰਕਾਰ ਦੁਆਰਾ ਚਲਾਏ ਅਤੇ ਨਿਧਾਨ ਕੀਤੇ ਜਾਂਦੇ ਹਨ ਅਤੇ ਇਸ ਦੇ ਵੱਲੋਂ ਵਿਦਿਆਰਥੀਆਂ ਨੂੰ ਮੁਫਤ ਜਾਂ ਸਸਤੇ ਸਿਖਲਾਈ ਪ੍ਰਦਾਨ ਕਰਨ ਦਾ ਉਪਦੇਸ਼ ਹੁੰਦਾ ਹੈ ਸਿਖਲਾਈ ਦੀ ਗੁਣਵੰਤ ਅਤੇ ਸੁ ਸੁਵਿਧਾਵਾਂ ਵੱਲੋਂ ਇਹਨਾਂ ਸਕੂਲਾਂ ਦਾ ਪੰਜਾਬ ਵਿੱਚ ਅੰਤਰ ਹੋ ਸਕਦਾ ਹੈ ਅਤੇ ਸਿਖਲਾਈ ਮਾਪਦੰਡ ਸਿੱਖਣ ਦੇ ਹਮਦਰਦੀ ਅਤੇ ਸਰੋਤਾਂ ਤੱਕ ਪਹੁੰਚਣ ਵਿੱਚ ਸੁਧਾਰ ਲਈ ਪ੍ਰਯਾਸ ਜਾਰੀ ਹਨ ਪੰਜਾਬ ਨੇ ਸਿੱਖਿਆ ਨਤੀਜੇ ਦੇ ਸੁਧਾਰ ਅਤੇ ਸਿਖਲਾਈ ਵਿਕਾਸ ਦੇ ਲਈ ਪ੍ਰਯਾਸ ਕੀਤੇ ਗਏ ਹਨ ਸਰਕਾਰੀ ਸਕੂਲਾਂ ਪੰਜਾਬ ਵਿੱਚ ਵਿਦਿਆਰਥੀਆਂ ਨੂੰ ਮੁਫਤ ਸਿਖਲਾਈ ਦੀ ਸਹੂ ਲਤਾ ਪ੍ਰਦਾਨ ਕਰਦੇ ਹਨ ਇਹ ਸਕੂਲ ਪੰਜਾਬ ਸਰਕਾਰ ਦੁਆਰਾ ਚਲਾਏ ਜਾਂਦੇ ਹਨ ਅਤੇ ਇਹਨਾਂ ਨੂੰ ਸਿੱਖਿਆ ਪ੍ਰਣਾਲੀ ਦੁਆਰਾ ਵਿਦਿਆਰਥੀਆਂ ਨੂੰ ਸਿੱਖਣ ਦਾ ਮੌਕਾ ਦਿੰਦੇ ਹਨ ਸਕੂਲ ਵਿੱਚ ਵਿਦਿਆਰਥੀਆਂ ਨੂੰ ਵੈਬ ਪੰਜੀਕਰਨ ਉਚਿਤ ਸਾਹਿਤਕ ਸ੍ਰੋਤਾਂ ਦੀ ਸੁਵਿਧਾ ਅਤੇ ਵਿਸ਼ੇਸ਼ ਸਿੱਖਿਆ ਪ੍ਰਦਾਨ ਕੀਤੀ ਜਾਂਦੀ ਹੈ ਪੰਜਾਬ ਦੇ ਸਰਕਾਰੀ ਸਕੂਲਾਂ ਦੀ ਸਿਖਲਾਈ ਨੂੰ ਸੁਧਾਰਨ ਲਈ ਕਈ ਯੋਜਨਾਵਾਂ ਚਲਾਈਆਂ ਜਾਂਦੀਆਂ ਹਨ ਜੋ ਵਿਦਿਆਰਥੀਆਂ ਦੇ ਸਿੱਖਣ ਹੱਲ ਸੰਬੰਧੀ ਪ੍ਰਤੀ ਦਿਨ ਵੱਧ ਰਹੇ ਹਨ ਮੈਂ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲ ਵਿੱਚ ਭੇਜਣਾ ਜ਼ਿਆਦਾ ਪਸੰਦ ਕਰਾਂਗੀ ਕਿਉਂਕਿ ਪ੍ਰਾਈਵੇਟ ਸਕੂਲਾਂ ਨਾਲੋਂ ਸਰਕਾਰੀ ਸਕੂਲਾਂ ਦੀ ਪੜ੍ਹਾਈ ਬਹੁਤ ਵਧੀਆ ਹੈ ਪ੍ਰਾਈਵੇਟ ਸਕੂਲਾਂ ਵਿੱਚ ਗਰੀਬ ਮਾਪੇ ਆਪਣੇ ਬੱਚੇ ਦੀ ਇੰਨੀ ਫੀਸ ਭਰਦੇ ਹਨ ਪਰ ਧਿਆਨ ਉਹਨਾਂ ਨੂੰ ਦੇ ਬੱਚੇ 'ਤੇ ਫਿਰ ਵੀ ਇੰਨਾਂ ਨਹੀਂ ਦਿੱਤਾ ਜਾਂਦਾ